ਮੈਨੂੰ ਇੱਕ ਕੰਪਨੀ ਵੱਲੋਂ ਨੌਕਰੀ ਦਾ ਇੰਟਰਵਿਊ ਦੇਣ ਲਈ ਤੁਰੰਤ ਬੁਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਆਪਣਾ ਪੈਨ ਕਾਰਡ ਵੀ ਜ਼ਰੂਰ ਲੈ ਕੇ ਆਉਣਾ ਹੈ ਅਤੇ ਮੇਰਾ ਪੈਨ ਕਾਰਡ ਗੁੰਮ ਹੋ ਗਿਆ ਹੈ ਅਤੇ ਮੈਂ ਹੈਲਪਲਾਈਨ ਸੈਂਟਰ 'ਤੇ ਕੌਲ ਕੀਤੀ ਅਤੇ ਉਹਨਾਂ ਨੂੰ ਸਾਰੀ ਸਥਿਤੀ ਸਮਝਾਈ ਕਿ ਕੱਲ੍ਹ ਮੈਂ ਬਠਿੰਡਾ ਗਈ ਸੀ ਅਤੇ ਉੱਥੇ ਬੱਸ ਸਟੈਂਡ 'ਤੇ ਮੇਰਾ ਪੈਨ ਕਾਰਡ ਡਿੱਗ ਗਿਆ ਸੀ ਅਤੇ